ਮੈਂ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਨਹਾ ਧੋਹ ਕੇ ਬਾਬਾ ਜੀ ਦਾ ਨਾਮ ਜਪਦੀ ਹਾਂ ਪੰਜ ਬਾਣੀਆਂ ਪਾਠ ਕਰਦੀ ਹਾਂ ਫਿਰ ਮੈਂ ਸਵੇਰੇ ਸੈਰ ਕਰਨ ਜਾਂਦੀ ਹਾਂ ਸੈਰ ਕਰਦੇ ਕਰਦੇ ਮੈਂ ਉੱਥੇ ਦੌੜ ਵੀ ਲਗਾਉਂਦੀ ਹਾਂ ਤਾਂ ਕਿ ਮੇਰਾ ਸਰੀਰ ਤੰਦਰੁਸਤ ਰਹੇ ਉਸ ਤੋਂ ਬਾਅਦ ਮੈਂ ਸਕੂਲ ਵੀ ਪੜ੍ਹਾਉਣ ਜਾਂਦੀ ਹਾਂ ਜੋ ਕਿ ਮੈਨੂੰ ਬਹੁਤ ਅੱਛਾ ਲੱਗਦਾ ਬੱਚਿਆਂ ਵਿੱਚ ਟਾਈਮ ਸਪੈਂਡ ਕਰਨਾ ਔਰ ਬੱਚਿਆਂ ਤੋਂ ਮੈਂ ਬਹੁਤ ਕੁਝ ਸਿੱਖਦੀ ਵੀ ਹਾਂ ਅਤੇ ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਨਾਲ ਪੜ੍ਹਾਉਣ ਦਾ ਮਜ਼ਾ ਵੀ ਆਉਂਦਾ ਹੈ ਉਸ ਤੋਂ ਬਾਅਦ ਮੈਨੂੰ ਮੈਂ ਡਾਂਸ ਦਾ ਬਹੁਤ ਜ਼ਿਆਦਾ ਸ਼ੌਂਕ ਆ ਮੈਨੂੰ ਡਾਂਸ ਕਲਾਸਿਜ ਲਈ ਮੈਂ ਇੱਕ ਟੀਚਰ ਰੱਖੀ ਹੋਈ ਹੈ ਜੋ ਕਿ ਮੈਨੇ ਇੱਕ ਘੰਟਾ ਆਣ ਕੇ ਸਿਖਾਉਂਦੇ ਹਨ ਮੈਂ ਡਾਂਸ ਬਹੁਤ ਲਗਨ ਨਾਲ ਸਿੱਖਦੀ ਹਾਂ ਅਤੇ ਮੈਨੂੰ ਉਹਦੇ ਕਰਕੇ ਕਈ ਪ੍ਰੋਗਰਾਮ ਵੀ ਆਉਂਦੇ ਹਨ ਜੇ ਮੈਂ ਬਾਹਰ ਇੰਟਰਨੈਸ਼ਨਲ ਲੈਵਲ 'ਤੇ ਵੀ ਜਾਂਦੀ ਹਾਂ ਉੱਥੋਂ ਜਿੱਤ ਕੇ ਵੀ ਆਉਂਦੀ ਹਾਂ ਉਸ ਤੋਂ ਬਾਅਦ ਮੈਨੂੰ ਵਾਜਾ ਸਿੱਖਣ ਦਾ ਬਹੁਤ ਸ਼ੌਂਕ ਹੈ ਮੈਂ ਸ਼ਬਦ ਕੀਰਤਨ ਵੀ ਕਰਦੀ ਹਾਂ ਤਾਂ ਕਿ ਉਸ ਤੋਂ ਵੀ ਮੈਂ ਉੱਚੇ ਪੱਧਰ 'ਤੇ ਇਨਾਮ ਜਿੱਤ ਸਕਾਂ ਗੁਰੂ ਦੇ ਨਾਲ ਪੂਰਾ ਪੂਰਾ ਜੁੜੇ ਹੋਏ ਹਾਂ ਉਹਦੀ ਵੀ ਬਹੁਤ ਦਿਲਚਸਪੀ ਹੈ ਕਿ ਜਿੱਥੇ ਅਸੀਂ ਬਾਕੀ ਚੀਜ਼ਾਂ ਖੇਡਦੇ ਹਾਂ ਤਾਂ ਆਪਾਂ ਗੁਰੂ ਦੇ ਨਾਲ ਵੀ ਪਿਆਰ ਪੂਰਾ ਰੱਖੀਏ ਫਿਰ ਅਸੀਂ ਬੈਡਮਿੰਟਨ ਵੀ ਮੈਂ ਖੇਡਦੀ ਹਾਂ ਮੈਂ ਕ੍ਰਿਕਟ ਵੀ ਖੇਡਦੀ ਹਾਂ ਤਾਂ ਕਿ ਮੈਂ ਅੱਛੇ ਲੈਵਲ 'ਤੇ ਜਾ ਕੇ ਕੁਛ ਬਣ ਸਕਾਂ ਅਤੇ ਮੈਂ ਕਿਸੇ ਗਰੀਬ ਦੀ ਮਦਦ ਵੀ ਕਰ ਸਕਾਂ ਹੋਰ ਮੈਨੂੰ ਸਟਿਚਿੰਗ ਕਰਨ ਦਾ ਬਹੁਤ ਸ਼ੌਂਕ ਹੈ ਮੈਂ ਜਿਹੜੀ ਸਟਿਚਿੰਗ ਆ ਉਹ ਫਰੀ ਟਾਈਮ ਦੇ ਵਿੱਚ ਇਕ ਘੰਟਾ ਉਹ ਵੀ ਕਰਦੀ ਆਂ ਕਿਉਂਕਿ ਮੈਂ ਆਪਣੇ ਸੂਟ ਆਪ ਸੀਣਾ ਪਸੰਦ ਕਰਦੀ ਹਾਂ ਮੈਨੂੰ ਕਿਸੇ ਦੀ ਵੀ ਫਿਟਿੰਗ ਪਸੰਦ ਨਹੀਂ ਆਉਂਦੀ ਇਸ ਲਈ ਮੈਂ ਆਪਣੇ ਸੂਟ ਆਪ ਸਟਿੱਚ ਕਰਕੇ ਆਪਣੇ ਆਪ ਨੂੰ ਬੜਾ ਕੰਫਰਟੇਬਲ ਸਮਝਦੀ ਹਾਂ ਹੋਰ ਮੈਨੂੰ ਆਪਣਾ ਘਰ ਸਜਾਉਣ ਦੀ ਬਹੁਤ ਜ਼ਿਆਦਾ ਮਤਲਬ ਸ਼ੌਂਕ ਆ ਅਤੇ ਮੈਂ ਫੋਨ ਦੇ ਉੱਤੋਂ ਦੇਖ ਰਹੀ ਹਾਂ ਡੈਕੋਰੇਸ਼ਨ ਪੀਸ ਕਿਸ ਤਰ੍ਹਾਂ ਬਣਦੇ ਨੇ ਉਸ ਤਰ੍ਹਾਂ ਹੀ ਮੈਂ ਸੁੰਦਰ ਸੁੰਦਰ ਡੈਕੋਰੇਸ਼ਨ ਪੀਸ ਬਣਾ ਕੇ ਆਪਣੇ ਘਰ ਨੂੰ ਬਹੁਤ ਵਧੀਆ ਢੰਗ ਨਾਲ ਸਜਾਉਂਦੀ ਹਾਂ ਮੇਰੇ ਘਰ ਵਿੱਚ ਜਿੰਨੇ ਵੀ ਆਉਂਦੇ ਹਨ ਉਹ ਮੈਨੂੰ ਪੁੱਛਦੇ ਹਨ ਕਿ ਇਹ ਪੀਸ ਕਿਸ ਤਰ੍ਹਾਂ ਬਣਾਇਆ ਫਿਰ ਮੈਂ ਉਹਨਾਂ ਨੂੰ ਦੱਸਦੀ ਹਾਂ ਅਤੇ ਮੈਂ ਉਹਨਾਂ ਦੀ ਵੀ ਹੈਲਪ ਕਰਦੀ ਹਾਂ ਥੈਂਕ ਯੂ ਧੰਨਵਾਦ